ਹਰ ਇੱਕ ਡਰਾਇੰਗ ਕਰਨ ਤੋਂ ਪਹਿਲਾਂ ਸਾਨੂੰ ਉਸ ਦੇ ਵਿੱਚ ਦਰਸਾਉਣ ਵਾਲੇ ਤੱਤਾਂ ਅਤੇ ਵਿਸ਼ਿਆਂ ਦੇ ਨਾਲ ਪਹਿਲਾਂ ਜਾਣੂ ਹੋਣਾ ਪੈਂਦਾ ਹੈ ਕਿ ਤੁਸੀਂ ਡਰਾਇੰਗ ਕਿਸ ਕੰਮ ਦੇ ਲਈ ਬਣਾਉਣ ਜਾ ਰਹੇ ਹੋ ਅਤੇ ਉਸਦੇ ਲਈ ਸਾਨੂੰ ਆਪਣੀ ਪੂਰੀ ਯੋਜਨਾਬੰਦੀ ਅਤੇ ਖਾਕਾ ਤਿਆਰ ਕਰਨਾ ਪੈਂਦਾ ਹੈ ਔਰ ਪਹਿਲਾਂ ਸਾਨੂੰ ਸਾਰਾ ਆਪਣੇ ਮਨ ਦੇ ਵਿੱਚ ਇੱਕ ਖਾਕਾ ਤਿਆਰ ਕਰਕੇ ਇਹ ਦੇਖਣਾ ਪੈਂਦਾ ਹੈ ਕਿ ਡਰਾਇੰਗ ਕਿਸ ਤਰ੍ਹਾਂ ਦੀ ਬਣਾਈ ਜਾਵੇ ਜਿਸ ਦੇ ਵਿੱਚ ਜਿਸ ਵਿਸ਼ੇ ਨੂੰ ਆਪਾਂ ਲੈ ਕੇ ਡਰਾਇੰਗ ਬਣਾਉਣਾ ਚਾਹੁੰਦੇ ਹਾਂ ਕਿ ਉਹ ਵਿਸ਼ਾ ਉਸ ਡਰਾਇੰਗ ਦੇ ਵਿੱਚ ਪੂਰਾ ਉੱਤਰਦਾ ਹੈ ਅਤੇ ਅਸੀਂ ਜਦੋਂ ਦੇਖਦੇ ਹਾਂ ਕਿ ਇਸ ਤਰ੍ਹਾਂ ਦੀ ਡਰਾਇੰਗ ਦੇ ਨਾਲ ਸਾਡਾ ਜਿਹੜਾ ਵਿਸ਼ਾ ਹੈ ਉਹ ਜ਼ਿਆਦਾ ਚੰਗੇ ਤਰੀਕੇ ਦੇ ਨਾਲ ਦੇਖਿਆ ਜਾ ਸਕਦਾ ਹੈ ਤਾਂ ਅਸੀਂ ਫਿਰ ਡਰਾਇੰਗ ਨੂੰ ਉਸ ਤਰ੍ਹਾਂ ਬਣਾ ਦਿੰਦੇ ਹਾਂ ਜਿਵੇਂ ਕਿ ਅਸੀਂ ਇਹ ਦੇਖਣਾ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਦਰੱਖਤਾਂ ਦਾ ਕੀ ਮਹੱਤਵ ਜਾਣਦੇ ਹਾਂ ਉਸਦੇ ਲਈ ਅਸੀਂ ਇਹ ਦੇਖਾਂਗੇ ਕਿ ਸਾਨੂੰ ਇਸ ਤਰ੍ਹਾਂ ਦੀ ਡਰਾਇੰਗ ਬਣਾਉਣੀ ਚਾਹੀਦੀ ਹੈ ਜਿਸ ਵਿੱਚ ਦਰੱਖਤਾਂ ਤੋਂ ਹੋਣ ਵਾਲੇ ਸਾਨੂੰ ਫਾਇਦੇ ਸਾਰੇ ਪਤਾ ਹੋਣ ਅਤੇ ਸਾਡੀ ਡਰਾਇੰਗ ਦੇ ਵਿੱਚ ਉਹ ਝਲਕਣ ਅਤੇ ਇਹ ਵੀ ਪਤਾ ਹੋਣਾ ਚਾਹੀਦਾ ਹੈ ਜੇ ਦਰੱਖਤ ਨਹੀਂ ਹੋਣਗੇ ਤਾਂ ਸਾਡੀ ਜ਼ਿੰਦਗੀ ਵਿੱਚ ਉਸ ਦਾ ਕੀ ਅਸਰ ਪਵੇਗਾ ਅਤੇ ਇਹ ਸਾਰਾ ਕੁਛ ਦਿਖਾਉਣ ਵਾਸਤੇ ਅਸੀਂ ਸਭ ਤੋਂ ਪਹਿਲਾਂ ਇਹ ਇੱਕ ਯੋਜਨਾ ਬਣਾਉਂਦੇ ਹਾਂ ਕਿ ਡਰਾਈੰਗ ਦੇ ਵਿੱਚ ਇਹ ਸਾਰੀਆਂ ਗੱਲਾਂ ਇੱਕ ਹੀ ਸਕੈਚ ਦੇ ਵਿੱਚ ਸਾਰੀਆਂ ਸ਼ੋ ਹੋ ਜਾਣ